ਸਤਿ ਸ਼੍ਰੀ ਅਕਾਲ ਮੈਮ ਮੈਮ ਮੈਂ ਨਵਾਂ ਨਵਾਂ ਮੂਵ ਹੋਇਆ ਇੱਥੇ ਤਰਨ ਤਰਨ 'ਚ ਨਿਊ ਜ਼ ਰੈਜੀਡੈਂਟ ਆਇਆ ਵਾਂ ਮੈਂ ਤੁਹਾਡੇ ਕੋਲੋ ਥੋੜ੍ਹੀ ਇਨਕੁਇਰੀ ਲੈਣੀ ਸੀ ਇਹ ਤਰਨ ਤਾਰਨ ਦਾ ਟਰਾਂਸਪੋਰਟ ਸਿਸਟਮ ਕਿਸ ਤਰ੍ਹਾਂ ਦਾ ਵਾ ਓਕੇ ਜਿਸ ਤਰ੍ਹਾਂ ਮੈਂ ਲੋਕਲ ਟਰੈਵਲ ਕਰਨਾ ਹੋਏ ਤਾਂ ਕਿਸ 'ਤੇ ਟਰੈਵਲ ਕਰਾਂ ਓਕੇ ਐਂਡ ਸਿਟੀ ਤੋਂ ਸਿਟੀ ਟਰਾਂਸਪੋਰਟ ਅੰਮ੍ਰਿਤਸਰ ਜਾਣ ਲਈ ਓਕੇ ਕੋਈ ਬੁੱਕ ਕਰਨ ਵਾਸਤੇ ਐਪਲੀਕੇਸ਼ਨ ਓਕੇ ਥੈਂਕ ਯੂ ਮੈਮ